ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹੁਕਮ ਕਰੋ ਜੀ ਅੱਛਾ ਜੀ ਠੀਕ ਹੈ ਜੀ ਵੇਖੋ ਜਿੱਦਾਂ ਸਾਡੇ ਕੋਲ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਪਿੰਡਾਂ ਦੇ ਵਿੱਚ ਬੜਾ ਕੁਝ ਹੈ ਜਿਵੇਂ ਅਨੰਦਪੁਰ ਸਾਹਿਬ ਹੈ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਹ ਦੇਖ ਸਕਦੇ ਹੋ ਉਹਦੇ ਵਿੱਚ ਅਜੂਬਾ ਬਣਾਇਆ ਹੋਇਆ ਇੱਕ ਹੈ ਉਹ ਵੀ ਦੇਖ ਸਕਦੇ ਹੋ ਬਾਕੀ ਸਰਹੰਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਉਹਨਾਂ ਦੀ ਸ਼ਹੀਦੀ ਹੋਈ ਹੈ ਉੱਥੇ ਦੇਖ ਸਕਦੇ ਹੋ ਬਾਕੀ ਇੱਕ ਸ਼ਹੀਦ ਭਗਤ ਸਿੰਘ ਨਗਰ ਹੈ ਨਵਾਂ ਸ਼ਹਿਰ ਉੱਥੇ ਭਗਤ ਸਿੰਘ ਜੱਦੀ ਪਿੰਡ ਹੈ ਉਥੇ ਤੁਸੀਂ ਬਿਜਨਸ ਕਰ ਸਕਦੇ ਹੋ ਅਤੇ ਜਿਹੜਾ ਸਾਡਾ ਟੂਰਿਸਟ ਕਰਾਇਆ ਵਗੈਰਾ ਉਹ ਅਸੀਂ ਛੋਟੀਆਂ ਬੱਸਾਂ ਵਿੱਚ ਤੁਸੀਂ ਇਕੱਲੇ ਹੋ ਜਾਂ ਫੈਮਲੀ ਨਾਲ ਹੋ ਕੋਈ ਨੀ ਮਿਲ ਜਾਏਗੀ ਜਦੋਂ ਵੀ ਤੁਸੀਂ ਆਏ ਤਾਂ ਮੈਨੂੰ ਨੇੜੇ ਆ ਕੇ ਕੋਲ ਕਰ ਲੈਣਾ ਸਾਡੀ ਲੋਕੇਸ਼ਨ ਮੈਂ ਤੁਹਾਨੂੰ ਭੇਜ ਦਿਵਾਂਗਾ ਉਥੇ ਬੈਠ ਕੇ ਤੁਹਾਡੀ ਗੱਲ ਹੋ ਜਾਵੇਗੀ ਅਤੇ ਜਦੋਂ ਵੀ ਜਿਥੇ ਵੀ ਤੁਸੀਂ ਕਹੋਗੇ ਉਹ ਤਾਂ ਤੁਹਾਨੂੰ ਦੱਸ ਦਿਆਂਗੇ ਸਾਰਾ ਠੀਕ ਹੈ